ਮੈਨੂੰ ਚਿੱਤਰਕਾਰੀ ਕਰਨ ਦਾ ਬਚਪਨ ਤੋਂ ਹੀ ਸ਼ੌਕ ਹੈ ਮੈਂ ਪੰਜਾਬੀ ਸੱਭਿਆ ਸੱਭਿਆਚਾਰ ਅਤੇ ਚਿੱਤਰਕਾਰੀ ਕਰਦੀ ਹਾਂ ਮੈਂ ਚਿੱਤਰਕਾਰੀ ਦੀ ਖੋਜ ਆਪਣੀ ਮੰਮਾ ਜਾਂ ਆਪਣੀ ਦਾਦੀ ਜੀ ਤੋਂ ਪੁੱਛਦੀ ਹਾਂ ਕਿਉਂਕਿ ਉਹਨਾਂ ਨੂੰ ਪੁਰਾਣੇ ਰੀਤੀ ਰਿਵਾਜਾਂ ਬਾਰੇ ਪਤਾ ਹੈ ਜਾਂ ਫਿਰ ਮੈਂ ਆਪਣੀ ਚਿਤਰਕਾਰੀ ਲਈ ਗੂਗਲ ਤੋਂ ਖੋਜ ਕਰਦੀ ਹਾਂ ਅਤੇ ਮੈਂ ਆਪਣੀ ਸਮੱਗਰੀ ਇਕੱਠੀ ਪੰਜਾਬ ਤੋਂ ਹੀ ਕਰਦੀ ਹਾਂ ਕਿਸੇ ਸ਼ੋਪ 'ਤੇ ਜਾ ਕੇ ਮੈਂ ਵਧੀਆ ਕੋਪਨੀ ਦੇ ਬੁਰਸ਼ ਅਤੇ ਚਾਕੂ ਖਰੀਦਦੀ ਹਾਂ ਮੈਨੂੰ ਕੋਮਲ ਪੇਂਟ ਕਲਰ ਵਧੀਆ ਲੱਗਦੇ ਹਨ ਕਿਉਂਕਿ ਉਹਨਾਂ ਦੀ ਕੋਂਪਨੀ ਬਹੁਤ ਹੀ ਜ਼ਿਆਦਾ ਵਧੀਆ ਹੈ ਉਹ ਵਾਟਰ ਪਰੂਫ ਕਲਰ ਹਨ ਅਤੇ ਮੈਂ ਬੁਰਸ਼ ਉਹ ਯੂਸ ਕਰਦੀ ਹਾਂ ਜੋ ਇੱਕ ਲੰਬੇ ਸਮੇਂ ਤੱਕ ਕੱਟਣ ਅਤੇ